ਸਤਿ ਸ਼੍ਰੀ ਅਕਾਲ ਜਿਵੇਂ ਕਿ ਸਾਨੂੰ ਪਤਾ ਹੈ ਕਿ ਜੋਗ ਜਿਹੜਾ ਇਹ ਯੋਗ ਹੈ ਉਹ ਬਹੁਤ ਜ਼ਰੂਰੀ ਹੈ ਸਾਡੇ ਸਰੀਰ ਲਈ ਯੋਗਾ ਸਾਡੇ ਲਈ ਬਹੁਤ ਜ਼ਰੂਰੀ ਹੈ ਯੋਗਾ ਦੇ ਬਹੁਤ ਸਾਰੇ ਫ ਬੈਨੀਫਿਟ ਵੀ ਹਨ ਕਿ ਯੋਗਾ ਸ਼ੁਰੂ ਸ਼ੁਰੂ 'ਚ ਜੇ ਸਾਤ ਕੋਈ ਯੋਗਾ ਕਰਦਾ ਉਹਦੇ ਲਈ ਬਹੁਤ ਬਹੁਤ ਸਾਰੇ ਨੈਵਗੇਟ ਅ ਮਤਲਬ ਚੁਣੌਤੀਆਂ ਆਉਂਦੀਆਂ ਹਨ ਜਿਵੇਂ ਕਿ ਉਹਦੇ ਕੋਲ ਕੋਈ ਇੱਕ ਟਾਈਮ ਟੇਬਲ ਨਹੀਂ ਬਣਾਉਂਦਾ ਕਿ ਕਿੰਨੇ ਵਜੇ ਉੱਠ ਕੇ ਅ ਜੋ ਅ ਯੋਗਾ ਕਰੀਏ ਅਤੇ ਫਿਰ ਕਈ ਕਈ ਵਾਰ ਉਹਨਾਂ ਦੇ ਮਤਲਬ ਮਤਲਬ ਉਹਨਾਂ ਦੇ ਜਿਹੜਾ ਯੋਗਾ ਉਹ ਕਦੀ ਕਦੀ ਅ ਥੋੜ੍ਹਾ ਹ ਡਿਫੀਕਲਟ ਹੁੰਦਾ ਮਤਲਬ ਅਤੇ ਅਤੇ ਥੋੜ੍ਹਾ ਉਹਨਾਂ ਦਾ ਜਿਹੜਾ ਯੋਗਾ ਉਹ ਈਜ਼ੀ ਹੁੰਦਾ ਦੂਜੇ ਸੋਰ 'ਤੇ ਡਿ ਡਿਫੀਕਲਟ ਜਿਹੜਾ ਯੋਗਾ ਹੁੰਦਾ ਉਸ ਉਹਨਾਂ ਦੇ ਬਹੁਤ ਸਾਰੇ ਮਤਲਬ ਥਕਾਵਟ ਆ ਜਾਂਦੀ ਹੈ ਤੋਜ ਮੈਂ ਮੇਰੇ ਲੇ ਮੇਰੇ ਮੇਰੇ ਜਿਹੜੇ ਮੰਮਾ ਪਾਪਾ ਉਹ ਵੀ ਯੋਗਾ ਕਰਦੇ ਹਨ ਸ਼ੁਰੂ ਸ਼ੁਰੂ 'ਚ ਉਹਨਾਂ ਨੂੰ ਵੀ ਬਹੁਤ ਸਾਰੇ ਬਹੁਤ ਸਾਰਾ ਚੁਣੌਤੀਆਂ ਆਈਆਂ ਸੀ ਜਿੱਦਾਂ ਕਿ ਉਹਨਾਂ ਦੀ ਰੁਟੀਨ ਨਹੀਂ ਸੀ ਬਣੀ ਬਣਦੀ ਕਿ ਕਿੰਨੇ ਵਜੇ ਉਹਨਾਂ ਨੇ ਉੱਠਣਾ ਅਤੇ ਕਿੰਨੇ ਵਜੇ ਉਹਨਾਂ ਨੇ ਯੋਗਾ ਕਰਨਾ ਬਟ ਹੁਣ ਉਹਨਾਂ ਦੀ ਰੂਟੀਨ ਬਣ ਚੁੱਕੀ ਹੈ ਯੋਗਾ ਦੇ ਯੋਗਾ ਕਰਨ ਦੇ ਨਾਲ ਨਾਲ ਮਤਲਬ ਅ ਸਾਡਾ ਜਿਹੜਾ ਸਰੀਰ ਆ ਉਹ ਉਹ ਤਾਕਤਵਰ ਹੋ ਜਾਂਦਾ ਅਤੇ ਸਾਨੂੰ ਯੋਗਾ ਕਰਦੇ ਹਾਂ ਫਿਰ ਸਾਡੇ ਮਤਲਬ ਜਿਹੜਾ ਸਰੀਰ ਆ ਉਹ ਠੀਕ ਠਾਕ ਹੁੰਦਾ ਸਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਜਿੱਦਾਂ ਅੱਜ ਕੱਲ੍ਹ ਦੇ ਲੋਕਾਂ 'ਚ ਅ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਅਤੇ ਉਹ ਬਿਮਾਰੀ ਨਹੀਂ ਲੱਗਦੀ